ਹੈਲੋ ਮੈਂ ਅੰਮ੍ਰਿਤ ਕੌਰ ਬੋਲਦੀ ਹਾਂ ਜੀ ਤੁਸੀਂ ਜਮੈਟੋ ਕੰਪਨੀ ਤੋਂ ਬੋਲਦੇ ਹੋ ਹਾਂਜੀ ਸਰ ਮੈਂ ਤੁਹਾਡੇ ਇੱਥੇ ਔਡਰ ਕੀਤਾ ਸੀਗਾ ਪਰ ਹ ਔਡਰ ਕੀਤੇ ਨੂੰ ਦੋ ਘੰਟੇ ਹੋ ਗਏ ਹਜੇ ਤੱਕ ਤੁਹਾਡਾ ਕੋਈ ਡਿਲੀਵਰੀ ਬੋਆਏ ਨਹੀਂ ਪਹੁੰਚਿਆ ਮੇਰੇ ਕੋਲ ਸਰ ਮੈਂ ਲੰਚ ਦੇ ਵਿੱਚ ਮੇਰੇ ਲੰਚ ਦੇ ਵਿੱਚ ਮੈਂ ਦਾਲ ਮੱਖਣੀ ਸ਼ਾਹੀ ਪਨੀਰ ਮਿਕਸ ਸਬਜ਼ੀ ਮਿੱਠੇ ਦੇ ਵਿੱਚ ਹਲਵਾ ਔਰ ਚਪਾਤੀ ਔਡਰ ਕੀਤੀ ਸੀ ਅੱਜ ਅਚਾਨਕ ਮੇਰੇ ਘਰ ਗੈੱਸਟ ਆ ਰਹੇ ਸੀਗੇ ਇਸ ਕਰਕੇ ਮੈਂ ਇੱਥੋਂ ਤੁਹਾਡੇ ਇੱਥੋਂ ਦਾ ਖਾਣਾ ਵਧੀਆ ਹੁੰਦਾ ਮੈਂ ਪਹਿਲੇ ਵੀ ਮੰਗਵਾਉਂਦੀ ਹਾਂ ਇਸ ਲਈ ਮੈਂ ਤੁਹਾਡੇ ਇੱਥੋਂ ਹੀ ਜਮੈਟੋ ਤੋਂ ਹੀ ਔਡਰ ਕੀਤਾ ਨਹੀਂ ਤਾਂ ਮੈਂ ਕਿਸੇ ਹੋਰ ਕੰਪਨੀ ਤੋਂ ਵੀ ਕਰ ਸਕਦੀ ਸੀਗੀ ਪਲੀਜ਼ ਤੁਸੀਂ ਆਪਣੇ ਡਿਲੀਵਰੀ ਬੋਆਏ ਨੂੰ ਕਾਲ ਕਰੋ ਕਿ ਉਹ ਜਲਦੀ ਤੋਂ ਜਲਦੀ ਖਾਣਾ ਲੈ ਕੇ ਮੇਰੇ ਘਰ ਪਹੁੰਚੇ ਕਿਉਂਕਿ ਮੇਰੇ ਗੈਸਟ ਜਾਣ ਨੂੰ ਰੈਡੀ ਨੇ ਔਰ ਅੱਜ ਮਤਲਬ ਤੁਹਾਡਾ ਔਡਰ ਲੇਟ ਹੋਣ ਕਰਕੇ ਮੇਰੀ ਮੇਰੇ ਰਿਸ਼ਤੇਦਾਰਾਂ ਅੱਗੇ ਇੰਨੀ ਇੰਸਲਟ ਹੋ ਰਹੀ ਹੈ ਨਾ ਕਿ ਅਗਰ ਅੱਜ ਇਹ ਟਾਈਮ ਨਾਲ ਨਹੀਂ ਪਹੁੰਚਿਆ ਤਾਂ ਮੈਂ ਅੱਗੇ ਤੋਂ ਤੁਹਾਡੀ ਕੰਪਨੀ ਤੋਂ ਕੋਈ ਔਡਰ ਨਹੀਂ ਕਰਨਾ